ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਖੇਡਾਂ ਆ ਗਈਆਂ ਜੋ ਕਿ ਸਾਡੀ ਨਕਲੀ ਬੁੱਧੀ ਨਾਲ ਚਲਦੀਆਂ ਹਨ ਜਿਵੇਂ ਕਿ ਕਈਆਂ ਖੇਡਾਂ ਅਸੀਂ ਫੋਨ 'ਤੇ ਖੇਡਦੇ ਹਾਂ ਉਹਨਾਂ ਵਿੱਚੋਂ ਕਈ ਖੇਡਾਂ ਅਜਿਹੀਆਂ ਵੀ ਹਨ ਜੋ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀਆਂ ਹਨ ਨਾਲੇ ਉਹਨਾਂ ਨੂੰ ਸੋਚਣਾ ਘੱਟ ਕਰ ਦਿੰਦੀਆਂ ਹਨ ਜਿਵੇਂ ਕਿ ਪਿੱਛੇ ਜਿਹੇ ਕਈ ਗੇਮਾਂ ਆਈਆਂ ਸੀਗੀਆਂ ਜਿਹਨਾਂ ਨੇ ਲੋਕਾਂ ਦੇ ਦਿਮਾਗ ਖਰਾਬ ਕੀਤੇ ਸਨ ਨਾਲੇ ਉਹਨਾਂ ਦੇ ਅਕਾ ਅਕਾਊਂਟ 'ਚੋਂ ਵੀ ਕਾਫੀ ਪੈਸੇ ਖਰਾਬ ਹੋਏ ਸਨ ਨਾਲੇ ਇਹ ਜੇਕਰ ਅਸੀਂ ਗੱਲ ਕਰੀਏ ਫੋਨ 'ਤੇ ਗੇਮ ਖੇਡਣ ਨਾਲੋਂ ਫੋਨ 'ਤੇ ਗੇਮ ਖੇਡਣ ਨਾਲ ਸਾਡੀ ਨਜ਼ਰਾ ਵੀ ਖਰਾਬ ਹੁੰਦੀਆਂ ਹਨ ਦਿਮਾਗੀ ਦਿਮਾਗੀ ਸੋਚ ਵੀ ਘੱਟਦੀ ਹੈ ਜੇਕਰ ਅਸੀਂ ਜੇਕਰ ਅਸੀਂ ਖੇਡਣਾ ਚਾਹੀਏ ਬਾਹਰ ਦੀ ਖੇਡਣ ਦੇ ਕੰਪੈਰਟਿਵ ਦੀ ਵੀ ਜੇ ਅਸੀਂ ਗੱਲ ਕਰੀਏ ਨਕਲੀ ਖੇਡਾਂ ਦੀ ਇਹ ਸਾਨੂੰ ਬਹੁਤ ਹੀ ਖਰਾਬ ਕਰ ਰਹੀਆਂ ਹਨ ਜੋ ਕਿ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹ ਸਾਡੀ ਸ ਸੋਚਣ ਸ਼ਕਤ ਸ਼ਕਤੀ ਵੀ ਖਰਾਬ ਕਰ ਰਹੀਆਂ ਹਨ ਜਿਸ ਨਾਲ ਸਾਨੂੰ ਕਿ ਵ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਹੀ ਲੈਣ ਦੇਣ ਦੇ ਦੇ ਸ ਦੇਣਾ ਪੈ ਸਕਦਾ ਹੈ ਇਸ ਚੀਜ਼ ਨੂੰ ਲੈ ਕੇ